ਹੈਲੋ ਗੁੱਡ ਮੋਰਨਿੰਗ ਸਰ ਸਰ ਮੈਨੇ ਨਾ ਫਲਿਪਕਾਰਟ 'ਤੇ ਮੋਬਾਈਲ ਆਰਡਰ ਕਰਿਆ ਸੀਗਾ ਰੈਡਮੀ ਨੋਟ ਨਾਈਨ ਹਾਂਜੀ ਸਰ ਸਰ ਕੱਲ੍ਹ ਉਹ ਮੋਬਾਈਲ ਮੇਰੇ ਕੋਲ ਪਹੁੰਚਿਆ ਹੈਗਾ ਹਾਂਜੀ ਸਰ ਸਰ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ ਵੀ ਮੇਨੇ ਪਹਿਲੀ ਵਾਰ ਤੁਹਾਡੀ ਕੰਪਨੀ ਤੋਂ ਵੀ ਮਿਨਸ ਤੁਹਾਡੀ ਐਪ ਤੋਂ ਮੋਬਾਈਲ ਉਹ ਆਰਡਰ ਕਰਿਆ ਸੀਗਾ ਅਤੇ ਮੈਨੂੰ ਤੁਹਾਡੇ ਵੱਲੋਂ ਬਹੁਤ ਜ਼ਿਆਦਾ ਵਧੀਆ ਫੈਸਿਲਿਟੀ ਮਿਲੀ ਹੈ ਡਿਲੀਵਰੀ ਬੋਏ ਨੇ ਮੇਰੇ ਤੱਕ ਮੋਬਾਈਲ ਪਹੁੰਚਾਇਆ ਹੈਗਾ ਅਤੇ ਉਹਨੇ ਕੋਈ ਵੀ ਕੰਜੂਸੀ ਨਹੀਂ ਕੀਤੀ ਹੈਗੀ ਬਲਕਿ ਵਧੀਆ ਢੰਗ ਨਾਲ ਪੈਕਿੰਗ ਕਰੀ ਹੋਈ ਸੀਗੀ ਬਿਲਕੁਲ ਆਰਾਮ ਆਰਾਮ ਨਾਲ ਆਇਆ ਉਹ ਬਲਕਿ ਉਹਨੇ ਮੈਨੂੰ ਮੋਬਾਇਲ ਹੱਥ ਦੇ ਵਿੱਚ ਪਕੜਾਇਆ ਬਿੱਲ ਪਕੜਾਇਆ ਜਦੋਂ ਮੈਂ ਮੋਬਾਈਲ ਖੋਲ੍ਹਿਆ ਮੋਬਾਈਲ ਖੋਲ੍ਹ ਕੇ ਮੈਨੂੰ ਇੰਨੀ ਜ਼ਿਆਦਾ ਖੁਸ਼ੀ ਹੋਈ ਇੰਨੀ ਜ਼ਿਆਦਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਹੈਗਾ ਮੈਨੂੰ ਉਸ ਮੋਬਾਇਲ ਦਾ ਕੈਮਰਾ ਕੁਆਲਿਟੀ ਸਟੋਰੇਜ਼ ਮੈਮਰੀ ਇੰਨੀ ਜ਼ਿਆਦਾ ਬੈਸਟ ਲੱਗੀ ਵੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਹੈਗਾ ਹਾਂਜੀ ਸਰ ਹਾਂਜੀ ਸਰ ਸਰ ਤਹਿ ਦਿਲੋਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ ਇੰਨੀ ਵਧੀਆ ਸੋਨੇ ਮੈਨੂੰ ਫੈਸਿਲਿਟੀ ਦਿੱਤੀ ਇੰਨਾ ਵਧੀਆ ਮੀਨਿੰਗ ਡਿਲੀਵਰੀ ਬੋਏ ਸੀਗਾ ਉਸ ਨੇ ਮੇਰੇ ਨਾਲ ਵੀ ਮੈਨੂੰ ਵਧੀਆ ਟੋਕਿੰਗ ਕਰਕੇ ਮੈਨੂੰ ਸਾਰੀ ਮੋਬਾਇਲ ਦਾ ਸਿਸਟਮ ਸਮਝਾਇਆ ਠੀਕ ਹੈ ਅਤੇ ਬਿੱਲ ਮੇਰੇ ਹੱਥ ਦੇ ਵਿੱਚ ਪਕੜਾਇਆ ਠੀਕ ਹੈ ਜਦੋਂ ਮੈਂ ਮੋਬਾਈਲ ਖੋਲ੍ਹ ਕੇ ਦੇਖਿਆ ਤਾਂ ਮੀਨਿੰਗ ਮੇਰਾ ਫਸਟ ਐਕਸਪੀਰੀਅੰਸ ਇਸ ਅਕੋਰਡਿੰਗ ਸੀਗਾ ਵੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਹੈਗਾ ਵੀ ਇੰਨਾ ਵਧੀਆ ਕੈਮਰਾ ਇੰਨੀ ਵਧੀਆ ਸਟੋਰੇਜ ਇੰਨਾ ਵਧੀਆ ਸੀ ਕੈਟ ਦਾ ਚਾਰਜਰ ਠੀਕ ਹੈ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੈਰੀ ਵੈਰੀ ਥੈਂਕ ਯੂ ਸਰ ਵੀ ਸੋਨੇ ਮੈਨੂੰ ਇੰਨੀ ਵਧੀਆ ਫੈਸਲਿਟੀ ਪ੍ਰੋਵਾਈਡ ਕਰਵਾਈ ਇੰਨਾ ਵਧੀਆ ਮੋਬਾਇਲ ਦਿੱਤਾ ਮੋਬਾਈਲ ਪੀਸ ਬਿਲਕੁਲ ਫਰੈਸ਼ ਸੀਗਾ ਕਿਸੇ ਪਾਸਿਓਂ ਕੋਈ ਵੀ ਉਹਦੇ 'ਤੇ ਕਰੈ ਖਰੋਚ ਨਹੀਂ ਆਈ ਸੀਗੀ ਕਿਸੇ ਪਾਸੋਂ ਟੁੱਟਿਆ ਨਹੀਂ ਸੀਗਾ ਠੀਕ ਹੈ ਉਹਦੀ ਸਟੋਰੇਜ ਵਧੀਆ ਹੈਗੀ ਮੈਮਰੀ ਵਧੀਆ ਹੈਗੀ ਉਹਦੀ ਬੈਟਰੀ ਵਧੀਆ ਹੈਗੀ ਇੱਕ ਸਾਲ ਦਾ ਸੋਨੇ ਮੈਨੂੰ ਜਿਹਨੇ ਗਰੰਟੀ ਦਿੱਤੀ ਬਹੁਤ ਬਹੁਤ ਸਰ ਤੁਹਾਡਾ ਧੰਨਵਾਦ ਥੈਂਕ ਯੂ ਸੋ ਮਚ